ਮੇਰਾ ਮਨਪਸੰਦ ਸਫ਼ਰ ਜਾਂ ਹਾਈਕ ਸ਼ਿਮਲੇ ਵਿੱਚ ਸੀ ਮੈਂ ਆਪਣੇ ਕੋਲੇਜ ਦੇ ਵੱਲੋਂ ਐੱਨ ਐੱਸ ਐੱਸ ਸੀ ਯੂਨਿਟ ਦੇ ਥਰੂ ਇੱਕ ਕੈਂਪ ਲਗਾਉਣ ਗਿਆ ਸੀ ਜਿਹਦਾ ਨਾਮ ਸੀਗਾ ਐਡਵੈਂਚਰ ਕੈਂਪ ਇਸਦੇ ਵਿੱਚ ਆਪਾਂ ਕਾਫ਼ੀ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਦੇ ਹਾਂ ਠੀਕ ਆ ਕਾਫ਼ੀ ਤਰ੍ਹਾਂ ਦੀਆਂ ਮਤਲਬ ਹਾਈਕ ਹਾਈਕਿੰਗ ਕਰਦੇ ਹਾਂ ਠੀਕ ਹੈ ਮਾਊਂਟੇਨ ਕਲਿੰਬਿੰਗ ਰੋਕ ਕਲਿੰਬਿੰਗ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਕਾਫ਼ੀ ਆਪਾਂ ਹਾਈਕਿੰਗ ਕਰਦੇ ਹਾਂ ਅਤੇ ਇਸਦੇ ਵਿੱਚ ਆਪਾਂ ਕਾਫ਼ੀ ਸਾਰੇ ਦੋਸਤ ਗਏ ਸੀਗੇ ਔਰ ਪੰਜਾਬ ਡਿਸਟਰਿਕਟ ਵਿੱਚੋਂ ਅਲੱਗ ਅਲੱਗ ਸਟੇ ਅਲੱਗ ਅਲੱਗ ਸਿਟੀਸ ਚੋਂ ਪਰ ਮੈਂ ਆਪਣੇ ਨਾਲ ਆਪਣੇ ਕੋਲੇਜ ਤੋਂ ਆਪਣੇ ਇੱਕ ਫਰੈਂਡ ਨਾਲ ਗਿਆ ਸੀਗਾ ਆਪਾਂ ਉੱਥੇ ਕਾਫ਼ੀ ਵਧੀਆ ਤਰੀਕੇ ਨਾਲ ਹਾਈਕਿੰਗ ਕੀਤੀ ਪ੍ਰੋਪਰ ਪ੍ਰੀਕੋਸ਼ਨਜ਼ ਦੇ ਨਾਲ ਆਪਾਂ ਉੱਥੇ ਮਤਲਬ ਚੜ੍ਹੇ ਲਾਈਕ ਮਾਊਂਟੇਨ 'ਤੇ ਜੇ ਚੜਨਾ ਸੀਗਾ ਅਤੇ ਆ ਇੱਕ ਮੁੰਡਾ ਉੱਥੇ ਚੜ੍ਹ ਜਾਂਦਾ ਹੈ ਇਰੋ ਰੋਕ 'ਤੇ ਇੱਕ ਥੱਲੋਂ ਫਿਰ ਰੱਸੀ ਪਾ ਕੇ ਚੰਗੀ ਤਰ੍ਹਾਂ ਪ੍ਰੀਕੋਸ਼ਨ ਦੇ ਨਾਲ ਇੱਕ ਦੂਜੇ ਨੂੰ ਖਿੱਚਦੇ ਖਿੱਚਦੇ ਆਪਾਂ ਹਾਈਕ 'ਤੇ ਪਹੁੰਚ ਗਏ ਸੀਗੇ ਠੀਕ ਆ ਅਤੇ ਉੱਥੇ ਆਪਾਂ ਲਗਭਗ ਕੋਈ ਦਸ ਕੁ ਦਿਨ ਬਿਤਾਏ ਸੀਗੇ ਕਿਉਂਕਿ ਐਡਵੈਂਚਰ ਕੈਂਪ ਸੀਗਾ ਅਤੇ ਸਰਕਾਰ ਵੱਲੋਂ ਓਰਗੇਨਾਈਜ਼ ਕੀਤਾ ਗਿਆ ਸੀਗਾ ਅਤੇ ਓਹ ਆਪਾਂ ਘੱਟੋ ਘੱਟ ਇੱਥੇ ਦਸ ਦਿਨ ਬਿਤਾਏ ਮਤਲਬ ਈਵਨ ਆਪਾਂ ਕੈਂਪ ਦੇ ਵਿੱਚ ਰਹੇ ਰਾਤ ਬਾਹਰ ਤੰਬੂ ਲਾ ਕੇ ਉਹ ਐਕਸਪੀਰੀਅੰਸ ਮੈਨੂੰ ਕਾਫ਼ੀ ਵਧੀਆ ਲੱਗਾ ਮਤਲਬ ਆਪੇ ਬਣਾਉਣਾ ਆਪੇ ਖਾਣਾ ਉਥੇ ਲੱਕੜਾਂ ਇਕੱਠੀ ਕਰਕੇ ਅੱਗ ਬਾਲ ਕੇ ਫਿਰ ਉਹਦੇ ਉੱਪਰ ਕੁਝ ਵੀ ਪਕਾਉਣਾ ਫਿਰ ਆਪਣੇ ਹੱਥਾਂ ਨਾਲ ਬਣਾ ਕੇ ਯਾਰਾਂ ਦੋਸਤਾਂ 'ਚ ਮਿਲ ਵੰਡ ਕੇ ਖਾਣਾ ਇੰਨਾ ਸਾਡੇ ਆਪਸ 'ਚ ਬਹੁਤ ਵਧੀਆ ਕੋਡੀਨੇਸ਼ਨ ਵੀ ਪਿਆਰ ਵਧਿਆ ਅਤੇ ਬਹੁਤ ਵਧੀਆ ਲੱਗਾ ਸੀਗਾ